ਹਾਂ ਬੇਸ਼ਕ ਘਰਾਂ ਵਿੱਚ ਖਾਣਾ ਬਣਾਉਣ ਲਈ ਐਲ ਪੀ ਜੀ ਸਲੰਡਰ ਦੀ ਵਰਤੋਂ ਕਰਦੇ ਸਮੇਂ ਸੁਰੱਖਿਅਤ ਲਈ ਕਈ ਜਰੂਰਤਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਲੀਕ ਹੋਣ ਦੀ ਜਾਂਚ ਕਰੋ ਸਲੰਡਰ ਲਗਾਉਣ ਤੋਂ ਪਹਿਲਾਂ ਰੈਗੂਲੇਟਰ ਅਤੇ ਔਸ ਪਾਈਪ ਦੀ ਜਾਂਚ ਕਰੋ ਕੀ ਉਹ ਸਹੀ ਤਰਾਂ ਨਾਲ ਜੁੜੇ ਹੋਏ ਹਨ ਅਤੇ ਕਿਤੇ ਕੋਈ ਲੀਕ ਨਹੀਂ ਹੈ ਤੁਸੀਂ ਇਸ ਲਈ ਸਾਬਣ ਵਾਲੇ ਪਾਣੀ ਦੀ ਵਰਤੋਂ ਕਰ ਸਕਦੇ ਹੋ ਜੇ ਕੋਈ ਬੁਲਬੁਲਾ ਬਣਦਾ ਹੈ ਤਾਂ ਇਹ ਲੀਕ ਹੋਣ ਦਾ ਸੰਕੇਤ ਹੈ ਐਕਸ ਪਾਈਪ ਡੇਟ ਦੇਖੋ ਸਲੰਡਰ ਤੇ ਲਿਖੀ ਐਕਸਪਾਰੀ ਡੇਟ ਜਰੂਰ ਦੇਖੋ ਐਕਸਪਾਰੀ ਹੋਲ ਸਿਲੰਡਰ ਦੀ ਵਰਤੋਂ ਖਤਰਨਾਕ ਹੋ ਸਕਦੀ ਹੈ ਸਿਲੰਡਰ ਨੂੰ ਸਹੀ ਥਾਂ ਤੇ ਰੱਖੋ ਸਿਲੰਡਰ ਨੂੰ ਹਮੇਸ਼ਾ ਖੋਲੀ ਅਤੇ ਹਵਾਦਾਰ ਜਗਹਾ ਤੇ ਰੱਖੋ ਜਿੱਥੇ ਕੋਈ ਗਰਮੀ ਦਾ ਸਰੋਤ ਨਾ ਹੋਵੇ ਇਸ ਨੂੰ ਕਦੇ ਵੀ ਬੰਦ ਥਾਂ ਤੇ ਜਾ ਜਲਨਸ਼ੀਲ ਚੀਜ਼ਾਂ ਦੇ ਨੇੜੇ ਨਾ ਰੱਖੋ ਰੈਗੂਲੇਟਰ ਸਹੀ ਤਰਾਂ ਲਗਾਓ ਰੈਗੂਲੇਟਰ ਨੂੰ ਸਲੰਡਰ ਤੇ ਸਹੀ ਤਰਾਂ ਲਗਾਉਣ ਅਤੇ ਚੈੱਕ ਕਰੋ ਇਹ ਲੀਕ ਨਹੀਂ ਕਰ ਰਿਹਾ ਔਸ ਪਾਈਪ ਦੀ ਜਾਂਚ ਕਰੋ ਔਸ ਪਾਈਪ ਨੂੰ ਸਮੇਂ ਸਮੇਂ ਤੇ ਜਾਂਚ ਦੇ ਰਹੋ ਕਿ ਇਹ ਕਿਤੇ ਕਟੀ ਜਾਂ ਫਟੀ